ਮੈਂ ਭੁਪਿੰਦਰ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਅੱਜ ਤੁਹਾਡੇ ਨਾਲ ਭਾਰਤ ਵਿੱਚ ਕੁਛ ਸਮਾਜ ਦੁਆਰਾ ਬੰਦ ਕੀਤੀਆਂ ਗਈਆਂ ਪ੍ਰਥਾਵਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਹਾਂ ਜਿਹਦੇ ਵਿੱਚ ਸਭ ਤੋਂ ਪਹਿਲੀ ਪ੍ਰਥਾ ਹੈ ਸਤੀ ਪ੍ਰਥਾ ਸਤੀ ਪ੍ਰਥਾ ਸਾਡੇ ਪੁਰਾਤਨ ਭਾਰਤ ਤੋਂ ਚਲੀ ਆ ਰਹੀ ਇੱਕ ਅਜਿਹੀ ਪ੍ਰਥਾ ਸੀ ਜਿਸ ਦੇ ਵਿੱਚ ਪਤੀ ਦੀ ਮੌਤ ਦੌਰਾਨ ਉਸ ਦੀ ਉਹ ਬੀਵੀ ਨੂੰ ਜਿੰਦਾ ਜਲਾਅ ਦਿੱਤਾ ਜਾਂਦਾ ਸੀ ਇਸ ਪ੍ਰਥਾ ਵਿੱਚ ਕੋਹਿਸਟ ਸਾਰੀਆਂ ਔਰਤਾਂ ਨੂੰ ਜਿੰਦਾ ਜਲਾਇਆ ਗਿਆ ਅਤੇ ਸਮਾਜ ਦੁਆਰਾ ਇਸ 'ਤੇ ਖਿਲਾਫ਼ ਹੱਥ ਵੀ ਚੁੱਕੇ ਗਏ ਜਿਸ ਨੂੰ ਸਮੇਂ ਦੇ ਨਾਲ ਨਾਲ ਹੀ ਬੰਦ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਸਿੱਖਿਆਵਾਂ ਸਿੱਖਿਆਵਾਂ ਵਿੱਚ ਔਰਤਾਂ ਨੂੰ ਇੰਨਾ ਜ਼ਿਆਦਾ ਰੁਝਾਨ ਵੇਖਣ ਨੂੰ ਨਹੀਂ ਮਿਲਦਾ ਕੁਝ ਸਮੇਂ ਬਾਅਦ ਕੁਛ ਵਿਅਕਤੀਆਂ ਦੁਆਰਾ ਇਸ ਦਾ ਰੁਝਾਨ ਜਿਹੜਾ ਔਰਤਾਂ ਵੱਲ ਵਧਾਇਆ ਗਿਆ ਅਤੇ ਉਹਨਾਂ ਨੂੰ ਸਿੱਖਿਆ ਪ੍ਰਾਪਤ ਕਰਵਾਈ ਗਈ ਅਤੇ ਇਸਦੇ ਦੌਰਾਨ ਉਹਨਾਂ ਨੂੰ ਪੜ੍ਹਿਆ ਲਿਖਿਆ ਅਪਣਾਇਆ ਗਿਆ ਅਤੇ ਉਹਨਾਂ ਨੂੰ ਇੱਕ ਸਮਾਜ ਵਿੱਚ ਜਿਉਣ ਦਾ ਮੌਕਾ ਦਿੱਤਾ ਸਤੀ ਪ੍ਰਥਾ ਵਿੱਚ ਬਹੁਤ ਸਾਰੀਆਂ ਔਰਤਾਂ ਨੂੰ ਜਿੰਦਾ ਜਲਾਅ ਦਿੱਤਾ ਜਾਂਦਾ ਸੀ ਅਤੇ ਉਹਨਾਂ 'ਤੇ ਪਤੀ ਦੀ ਮੌਤ ਦੌਰਾਨ ਜਿੰਦਾ ਜਲਾਇਆ ਜਾਂਦਾ ਸੀ ਉਸਦੇ ਵਿੱਚ ਉਹਨਾਂ ਨੂੰ ਜਿੰਦਾ ਜਲਾਉਣ ਦਾ ਜਿਹੜਾ ਸਭ ਤੋਂ ਵੱਡਾ ਹੱਥ ਉਹਨਾਂ ਦੇ ਪਰਿਵਾਰ ਦਾ ਹੁੰਦਾ ਸੀ ਉਹਨਾਂ ਦੇ ਪਰਿਵਾਰ ਦੇ ਖੁਦ ਮੈਂਬਰ ਕੁਝ ਰਲ ਕੇ ਉਹਨਾਂ ਨੂੰ ਚਿਖਾ 'ਤੇ ਚੜਾਉਂਦੇ ਸਨ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਭਰੂਣ ਹੱਤਿਆ ਭਰੂਣ ਹੱਤਿਆ ਸਮਾਜ ਵਿੱਚ ਜਿਹੜੀ ਪਿਛਲੇ ਸਮੇਂ ਤੋਂ ਚਲਦੀ ਆ ਰਹੀ ਹੁਣ ਵੀ ਚਲਦੀ ਹੈ ਜਿਸ ਦੇ ਵਿੱਚ ਗਰਭ ਦੇ ਵਿੱਚ ਹੀ ਛੋਟੇ ਬੱਚੀਆਂ ਨੂੰ ਮਾਰ ਦਿੱਤਾ ਜਾਂਦਾ ਹੈ ਜ਼ਿਆਦਾਤਰ ਇਹ ਕੇਸ ਸਾਨੂੰ ਲੜਕੀਆਂ ਪੈਦਾ ਹੋਣ 'ਤੇ ਦੇਖਿਆ ਜਾਂਦਾ ਹੈ